ਮੈਂ ਭੁਪਿੰਦਰ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਅੱਜ ਤੁਹਾਡੇ ਨਾਲ ਕੁਝ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ ਜਿਸ ਵਿੱਚ ਮੈਂ ਆਪਣੇ ਇੱਕ ਮਿੱਤਰ ਦੋਸਤ ਨੂੰ ਇੱਕ ਕਾਵੀ ਲਿਖਿਆ ਹੈ ਓਤੇ ਉਹਨਾਂ ਵਿੱਚ ਉਸਨੂੰ ਕੀ ਪਸੰਦ ਆਇਆ ਮੈਂ ਤੁਹਾਡੇ ਨਾਲ ਇਹ ਸਾਂਝਾ ਕਰਨਾ ਚਾਹੁੰਦਾ ਮੇਰਾ ਇੱਕ ਦੋਸਤ ਭਾਵ ਕਿ ਮੇਰਾ ਦੋਸਤ ਸੂਰਜ ਨੂੰ ਮੈਂ ਇੱਕ ਕਵਿਤਾ ਲਿਖ ਕੇ ਭੇਜੀ ਜਿਸ ਵਿੱਚ ਉਹ ਕਵਿਤਾ ਉਸਦੀ ਜ਼ਿੰਦਗੀ ਦੇ ਕੁਝ ਘਟਨਾਵਾਂ ਨਾਲ ਅਧਾਰਿਤ ਸਬੰਧ ਰੱਖਦੀਆਂ ਸਨ ਜਿਵੇਂ ਕੀ ਉਸਦਾ ਸਕੂਲ ਪੜ੍ਹਨਾ ਉਸ ਤੇ ਪਰਿਵਾਰਿਕ ਸੰਬੰਧੀ ਅਤੇ ਉਸਦਾ ਅੰਦਰ ਬਾਹਰ ਜਾਣਾ ਸੂਰਜ ਦਾ ਜੇ ਜਿੰਦਗੀ ਨਾਲ ਉਹ ਕਵਿਤਾ ਕਾਫੀ ਮੇਲ ਜੋਲ ਰੱਖਦੀ ਸੀ ਜਿਸ ਕਰਕੇ ਸੂਰਜ ਨੂੰ ਉਹ ਕਵਿਤਾ ਬਹੁਤ ਹੀ ਜਿਆਦਾ ਪਸੰਦ ਆਈ ਅਤੇ ਕੁਝ ਕਰੈਕਟਰ ਭਾਵ ਕੁਝ ਲੋਕ ਮੈਂ ਉਸ ਕਵਿਤ ਵਿੱਚ ਇਸ ਤਰ੍ਹਾਂ ਦੇ ਰੱਖੇ ਸਨ ਕੀ ਉਹ ਸੂਰਜ ਨੂੰ ਸੂਰਜ ਦੀ ਜ਼ਿੰਦਗੀ ਨਾਲ ਬਿਲਕੁਲ ਹੀ ਮੇਲ ਖਾਂਦੇ ਸਨ ਤੇ ਉਹ ਸੂਰਜ ਨੂੰ ਬਹੁਤ ਪਸੰਦ ਆਏ ਸਨ ਸੂਰਜ ਦੀ ਨੂੰ ਇਹ ਕਾਵਿਤਾ ਉਸਨੂੰ ਬਹੁਤ ਪਸੰਦ ਆਈ ਅਤੇ ਉਸਨੇ ਇਹ ਕਵਿਤਾ ਆਪਣੇ ਅੱਗੇ ਯਾਰਾਂ ਦੋਸਤਾਂ ਨੂੰ ਵੀ ਸੁਣਾਈ ਅਤੇ ਪੜਾਈ ਜਿਸ ਨਾ ਨੇ ਇਸ ਕਵਿਤਾ ਦੀ ਬਹੁਤ ਹੀ ਜਿਆਦਾ ਤਾਰੀਫ ਕੀਤੀ ਅਤੇ ਮੈਨੂੰ ਵੀ ਕਾਫੀ ਖੁਸ਼ੀ ਮਿਲੀ ਕੀ ਮੇਰੀ ਲਿਖੀ ਕਵਿਤਾ ਮੇਰੇ ਦੋਸਤ ਨੂੰ ਇਨੀ ਪਸੰਦ ਆਈ ਅਤੇ ਉਸਦੇ ਚਾਹੁਣ ਵਾਲਿਆਂ ਨੂੰ ਵੀ ਬਹੁਤ ਪਸੰਦ ਆਈ ਉਸ ਕਵਿਤਾ ਦੇ ਕੁੱਲ ਪੰਨੇ ਨੌਂ ਸਨ ਉਹਨਾਂ ਨੌਆਂ ਪੰਨਿਆਂ ਦੇ ਵਿੱਚ ਪਹਿਲੇ ਪੇਜ ਤੇ ਦੀ ਤਾਰੀਫ ਦੂਸਰੇ ਪੰਨੇ ਤੇ ਉਸਦੇ ਜੀਵਨ ਬਾਰੇ ਤੀਸਰੇ ਪੰਨੇ ਤੇ ਆਪਣੀ ਦੋਸਤੀ ਦਾ ਮੇਲ ਜੋਲ ਅਤੇ ਚੌਥੇ ਪੰਨੇ ਤੇ ਉਸ ਦਾ ਸਕੂਲ ਪੜ੍ਹਨਾ ਪੰਜਵੇਂ ਪੰਨੇ ਤੇ ਉਸਨੂੰ ਕੀ ਪਸੰਦ ਸੀ ਉਹ ਛੇਵੇਂ ਪੰਨੇ ਤੇ ਉਸਦੀਆਂ ਕੁਝ ਆਦਤਾਂ ਸੱਤਵੇਂ ਪੰਨੇ ਤੇ ਸਾਡੀਆਂ ਲੜਾਈਆਂ ਅੱਠਵੇਂ ਪੰਨੇ ਤੇ ਸਾਡੇ ਪਿਆਰ ਦੇ ਕੁਛ ਬੋਲ ਤੇ ਨੌਵੇਂ ਪੰਨੇ ਤੇ ਸਾਡੀ ਜ਼ਿੰਦਗੀ ਦਾ ਮੇਲ ਜੋਲ ਸ਼ਾਮਲ ਸੀ ਇਹਨਾਂ ਪੰਨਿਆਂ ਵਿੱਚ ਮੈਂ ਉਸਦੀ ਜ਼ਿੰਦਗੀ ਨੂੰ ਕਾਫੀ ਗਹਿਰੇ ਤਰੀਕੇ ਨਾਲ ਲਿਖਿਆ ਅਤੇ ਉਸ ਨੂੰ ਸੁਣਾਇਆ ਤੇ ਪੜਾਇਆ ਜਿਸ ਕਰਕੇ ਉਸਨੂੰ ਇਹ ਬਹੁਤ ਪਸੰਦ ਆਇਆ